ਹੈਲੋ ਹਾਂ ਸਤਿ ਸ਼੍ਰੀ ਅਕਾਲ ਭਾਅ ਜੀ ਵਧੀਆ ਜੀ ਵਧੀਆ ਭਾਅ ਜੀ ਅਸੀਂ ਨਾ ਉਹ ਕਰਨਾ ਸੀਗਾ ਟਰਿੱਪ ਪਲੈਨ ਕਰਨਾ ਸੀ ਅਸੀਂ ਭਾਅ ਜੀ ਸਾਡੀ ਫੈਮਲੀ ਸੀ ਅਸੀਂ ਚਾਰ ਜਣੇ ਆ ਜਿਹਦੇ ਵਿੱਚ ਕਿ ਦੋ ਅਡਲਟ ਨੇ ਅਤੇ ਦੋ ਬੱਚੇ ਨੇ ਅਤੇ ਤੁਸੀਂ ਕੋਈ ਹਿੱਲ ਸਟੇਸ਼ਨ ਵਗੈਰਾ ਪ੍ਰੈਫਰ ਕਰਾਂਗੇ ਜਿੱਦਾਂ ਤੁਸੀਂ ਦੱਸੋ ਕਿੱਥੇ ਜਾ ਸਕਦੇ ਹਾਂ ਰਸ਼ ਵੱਧ ਜਾਂਦਾ ਜੀ ਹਾਂਜੀ ਨੇ ਤੁਸੀਂ ਪਲੈਨ ਸਾਨੂੰ ਸਾਰੇ ਹੀ ਦੱਸ ਦਿਓ ਤੁਹਾਡੇ ਕੋਲ ਕਿਹੜੇ ਕਿਹੜੇ ਹੈਗੇ ਆ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਭਾਅ ਜੀ ਪਲੇਨ 'ਚ ਕਿਹੜੀ ਜਗ੍ਹਾ ਲੈ ਕੇ ਜਾਓਗੇ ਭਾਅ ਜੀ ਅਤੇ ਗੋਆ ਵਗੈਰਾ ਦਾ ਕਿੰਨੇ ਦਾ ਪਊਗਾ ਜੀ

ਠੀਕ ਆ ਠੀਕ ਆ ਠੀਕ ਆ ਭਾਅ ਜੀ ਜੇ ਭਾਅ ਜੀ ਉੱਧਰ ਜਾਈਏ ਆਪਾਂ ਅਰੁਣਾਚਲ ਪ੍ਰਦੇਸ਼ ਵਾਲੀ ਸਾਈਡ ਉਹ ਕੀ ਪੈ ਜੂ ਆਪਾਂ ਨੂੰ ਮੈਂ ਕਿਹਾ ਨਹੀਂ ਭਾਅ ਜੀ ਅਰੁਣਾਚਲ ਪ੍ਰਦੇਸ਼ ਵਾਲੀ ਸਾਈਡ ਦਾਰਜਲਿੰਗ ਹੈ ਠੀਕ ਆ ਠੀਕ ਆ ਠੀਕ ਆ ਭਾਅ ਜੀ ਲੇਹ ਲ ਲੇਹ ਲਦਾਖ਼ ਦਾ ਕੀ ਪੈ ਜੂਗਾ ਆਪਾਂ ਨੂੰ ਠੀਕ ਆ ਠੀਕ ਆ ਠੀਕ ਆ ਭਾਅ ਜੀ ਚਲੋ ਫਿਰ ਮੈਂ ਤੁਹਾਡੇ ਕੋਲ ਆਪ ਮਿਲ ਕੇ ਆਉਣਾ ਤੁਹਾਡੇ ਕੋਲ ਅੱਜ ਨਾ ਹਾਂ ਸ਼ਾਮ ਨੂੰ ਆਉਣਾ ਤੁਹਾਡੇ ਕੋਲ ਸਾਡਾ ਭਾਅ ਜੀ ਜ਼ਿਆਦਾ ਗੋਆ ਵਗੈਰਾ ਦਾ ਹੀ ਸੀਗਾ ਠੀਕ ਆ ਠੀਕ ਆ ਠੀਕ ਆ ਭਾਅ ਜੀ ਹਾਂਜੀ ਧੰਨਵਾਦ ਜੀ